ਦੇਖੋ ਕਿਹਾ ਜਾਂਦਾ ਹੈ ਕਿ ਘਰ ਦੇ ਵਿਹੜੇ ਦੇ ਵਿੱਚ ਪੰਛੀ ਅਗਰ ਚਹਿਚਹਾਉਂਦੇ ਹੋਣ ਤਾਂ ਘਰ 'ਚ ਰੌਣਕ ਬਣੀ ਰਹਿੰਦੀ ਹੈ ਕਿਸੇ ਦੇ ਘਰ ਵਿੱਚ ਵੀ ਪੰਛੀਆਂ ਦਾ ਬਾਰ ਬਾਰ ਆਉਣਾ ਉਸ ਘਰ ਦੀ ਜਿਹੜੀ ਉਰਜਾ ਹੈ ਉਹਦੇ ਵਧੀਆ ਹੁੰਦੇ ਆ ਇੱਕ ਅੰਦੇਸ਼ਾ ਪੈਦਾ ਹੁੰਦਾ ਮੇਰੇ ਵਿਚਾਰ ਦੇ ਨਾਲ ਘਰ ਦੇ ਵਿੱਚ ਜਿਸ ਤਰ੍ਹਾਂ ਹੁਣ ਪੰਜਾਬ ਜਲੰਧਰ ਦੇ ਵਿੱਚ ਹੁਣ ਮਾਰਚ ਦਾ ਮਹੀਨਾ ਜਿਹੜਾ ਆਉਣ ਵਾਲਾ ਉਹਦੇ ਵਿੱਚ ਹੀ ਗਰਮੀਆਂ ਸ਼ੁਰੂ ਹੋ ਜਾਣਗੀਆਂ ਅਤੇ ਪਕਸ਼ੀਆਂ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਇਹ ਮੌਸਮ ਐਸਾ ਹੋਵੇਗਾ ਜਿਸ ਤਰ੍ਹਾਂ ਧੁੱਪ ਜਿਹੜੀ ਬਹੁਤ ਤੇਜ਼ ਹੁੰਦੀ ਹੈ ਪੰਛੀਆਂ ਨੂੰ ਛਾਂ ਦੀ ਵੀ ਜ਼ਰੂਰਤ ਹੁੰਦੀ ਆ ਤੋ ਇਹ ਦੋਨਾਂ ਚੀਜ਼ਾਂ ਦੀ ਅਗਰ ਆਪਾਂ ਪੂਰਤੀ ਕਰਦੇ ਹਾਂ ਤਾਂ ਤੁਹਾਡੇ ਘਰ ਦੇ ਵਿੱਚ ਤੁਹਾਡੇ ਵਿਹੜੇ ਦੇ ਵਿੱਚ ਪੰਛੀਆਂ ਦਾ ਆਉਣਾ ਜਾਣਾ ਜਿਹੜਾ ਨਾ ਉਹ ਬੜੇ ਵਧੀਆ ਤਰੀਕੇ ਦੇ ਨਾਲ ਬਣਿਆ ਰਹਿੰਦਾ ਤੁਸੀਂ ਆਪਣੇ ਘਰ ਦੇ ਵਿੱਚ ਗਮਲੇ ਰੱਖ ਸਕਦੇ ਹੋ ਐਸੇ ਗਮਲੇ ਜਿਹਦੇ ਨਾਲ ਛੋਟੀ ਮੋਟੀ ਛਾਂ ਜਿਹੜੀ ਹੈ ਉਹ ਬਣੀ ਰਹੇ ਉਸ ਛਾਂ ਦੇ ਨਾਲ ਪਕਸ਼ੀ ਆ ਕੇ ਗਮਲਿਆਂ ਦੇ ਵਿੱਚ ਲੱਗੇ ਹੋਏ ਪੌਦਿਆਂ ਦੀ ਟਹਿਣੀਆਂ 'ਤੇ ਬੈਠਦੇ ਹਨ ਤੁਸੀਂ ਆਪਣੇ ਘਰ ਦੇ ਵਿੱਚ ਜਿਹੜੇ ਬਨਾਵਟੀ ਤਰ੍ਹਾਂ ਦੇ ਘੌਸਲੇ ਆਉਂਦੇ ਨੇ ਉਹ ਲਿਆ ਕੇ ਟੰਗ ਸਕਦੇ ਹੋ ਤੁਸੀਂ ਲੱਕੜੀ ਦੇ ਨਾਲ ਬਣਾਏ ਹੋਏ ਛੋਟੇ ਛੋਟੇ ਘਰੌਂਦੇ ਜਿਹੜੇ ਨੇ ਉਹ ਆਪਣੇ ਘਰ ਦੀ ਬਾਹਰ ਦੀ ਦੀਵਾਰ ਦੇ ਉੱਪਰ ਰੱਖ ਸਕਦੇ ਹੋ ਤੋ ਪਕਸ਼ੀ ਜਿਹੜੇ ਨੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਬੜੇ ਆਕਰਸ਼ਿਤ ਹੁੰਦੇ ਨੇ ਇਸ ਤੋਂ ਇਲਾਵਾ ਤੁਸੀਂ ਪੰਛੀਆਂ ਦੇ ਪਾਣੀ ਪੀਣ ਵਾਸਤੇ ਕੋਈ ਪਾਣੀ ਦਾ ਛੰਨਾ ਭਰ ਕੇ ਰੱਖ ਸਕਦੇ ਹੋ ਜਿਹਦੇ ਕਰਕੇ ਪੰਛੀਆਂ ਨੂੰ ਕਾਫ਼ੀ ਸਹੂਲੀਅਤ ਹੁੰਦੀ ਹੈ ਧੰਨਵਾਦ